ਵੀਡੀਓ ਕਾਨਫਰਸਿੰਗ ਦਾ ਹੁਨਰ ਆਧੁਨਿਕ ਸੰਸਾਰ ਵਿੱਚ ਬਹੁਤ ਹੀ ਮਹੱਤਵਪੂਰਨ ਅਤੇ ਕਿਫਾਇਤੀ ਹੈ ਕਿਉਂਕਿ ਵੀਡੀਓ ਕਾਨਫਰਸਿੰਗ ਦੇ ਬਹੁਤ ਜ਼ਿਆਦਾ ਫ਼ਾਇਦੇ ਹੈ ਵੀਡੀਓ ਕਾਨਫਰਸਿੰਗ ਵਿੱਚ ਇੱਦਾਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਆਪਣਾ ਗੱਲ ਪਹੁੰਚਾ ਸਕਦਾ ਹੈ ਜਿੱਦਾਂ ਕਿ ਕੋਈ ਵੀ ਆਪਣੇ ਭੈਣ ਭਰਾ ਸਕੇ ਸਬੰਧੀ ਨਾਲ ਗੱਲ ਕਰਨੀ ਹੋਵੇ ਉਹਨਾਂ ਨੂੰ ਦੇਖਣਾ ਹੋਵੇ ਤਾਂ ਵੀਡੀਓ ਕਾਨਫਰਸਿੰਗ ਦੇ ਨਾਲ ਆਪਾਂ ਉਹਨਾਂ ਨੂੰ ਉਹਨਾਂ ਦੇ ਗੱਲਬਾਤ ਕਰ ਸਕਦੇ ਹਾਂ ਔਰ ਦੇਖ ਸਕਦੇ ਹੈ ਪਰ ਸੈਕਿੰਡ ਜਿੱਦਾਂ ਆਪਣਾ ਕੋਈ ਬਿਜਨਸ ਕਰਦਾ ਹੋਵੇ ਕੁਛ ਸਮਾਨ ਵਗੈਰਾ ਦਿਖਾਉਣਾ ਹੋਵੇ ਚੈੱਕ ਕਰਵਾਉਣਾ ਹੋਵੇ ਤਾਂ ਵੀਡੀਓ ਕਾਨਫਰਸਿੰਗ ਦੇ ਨਾਲ ਉਹ ਆਪਣਾ ਸਮਾਨ ਵਗੈਰਾ ਦਿਖਾ ਸਕਦਾ ਅਤੇ ਬਿਜਨਸ ਵਗੈਰਾ ਨੂੰ ਅੱਗੇ ਵਧਾ ਸਕਦਾ ਔਰ ਥਰਡ ਇਜ ਕਿ ਮੀਟਿੰਗ ਵਗੈਰਾ ਕਰਨੀ ਹੋਵੇ ਤਾਂ ਵੀਡੀਓ ਕਾਨਫਰਸਿੰਗ ਦਾ ਬੜਾ ਹੀ ਇਜੀ ਤਰੀਕਾ ਹੈ ਮੀਟਿੰਗ ਕਰਨ ਦਾ ਵੀਡੀਓ ਕਾਨਫਰਸਿੰਗ ਦੇ ਨਾਲ ਅਤੇ ਇੱਦਾਂ ਇੱਕ ਸਥਾਨ ਤੋਂ ਦੂਸਰੇ ਸਥਾਨ ਤੱਕ ਨਹੀਂ ਜਾ ਸਕਦਾ ਬੰਦਾ ਅਤੇ ਆਪਣੇ ਆਫਿਸ 'ਚ ਬੈਠ ਕੇ ਦੂਸਰੇ ਆਫਿਸ ਦੇ ਨਾਲ ਅਗਰ ਦੂਸਰੇ ਦੇਸ਼ ਵਿੱਚ ਵੀ ਹੋਵੇ ਤਾਂ ਵੀ ਵੀਡੀਓ ਕਾਨਫਰਸਿੰਗ ਦੇ ਨਾਲ ਆਪਣੀ ਮੀਟਿੰਗ ਕਰ ਸਕਦਾ ਆਪਣੀ ਗੱਲ ਪਹੁੰਚਾ ਸਕਦਾ ਔਰ ਦੇਖ ਵੀ ਸਕਦਾ ਹੈ ਇਸ ਕਰਕੇ ਆਉਣ ਵਾਲੇ ਯੁਗ ਵਿੱਚ ਸੰਸਾਰ ਵਿੱਚ ਵੀਡੀਓ ਕਾਨਫਰਸਿੰਗ ਬੜਾ ਇੱਕ ਮਹੱਤਵਪੂਰਨ ਹੋਰਨ ਹੁਨਰ ਹੈ ਜੋ ਕਿ ਹਰ ਕਿਸੇ ਨੂੰ ਆਉਣਾ ਚਾਹੀਦਾ ਹੈ